ਸਾਡਾ ਇਕ ਕੰਪਿਊਟਰ ਦਾ ਦਫ਼ਤਰ ਹੈ ਅਸੀਂ ਕੰਪਿਊਟਰ ਦਾ ਕੰਮ ਕਰਦੇ ਹਾਂ ਅਤੇ ਸਾਡੇ ਕੁਛ ਕੰਪਿਊਟਰ ਖ਼ਰਾਬ ਹੋ ਚੁੱਕੇ ਹਨ ਜੋ ਕਿ ਜਿਵੇਂ ਮਾਊਸ ਅਤੇ ਪੀ ਸੀ ਵਗੈਰਾ ਮਾਊਸ ਕੀਬੋਰਡ ਪੀ ਸੀ ਓ ਅਤੇ ਇਹਨਾਂ ਨੂੰ ਠੀਕ ਕਰਨ ਲਈ ਸਾਨੂੰ ਇੱਕ ਵਰਕਰ ਦੀ ਜ਼ਰੂਰਤ ਹੈ ਅਤੇ ਤਾਂ ਕਿ ਕੁਛ ਸਹੀ ਕੰਪਿਊਟਰ ਸ ਠੀਕ ਕਿੱਥੇ ਜਾਣ ਅਤੇ ਵੇਸਟ ਇੱਕ ਸਾਈਡ 'ਤੇ ਕੀਤੇ ਜਾਣ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਦਿੱਤੀ ਜਾਵੇ